ਹਾਂਜੀ ਪਹਿਲਾਂ ਵੀ ਮੈਂ ਸ਼ੂਜ ਮੰਗਵਾਏ ਸੀ ਉਹ ਤਾਂ ਬਹੁਤ ਵਧੀਆ ਨਿਕਲੇ ਦੋ ਤਿੰਨ ਵਾਰ ਚੀਜਾਂ ਮੰਗਾਈਆਂ ਮੈਂ ਇੱਥੋਂ ਵੱਖ ਵੱਖ ਸਾਰੀਆਂ ਠੀਕ ਨਿਕਲਦੀਆਂ ਤਕਰੀਬਨ ਮਗਰ ਇਸ ਵਾਰੀ ਮੈਂ ਹੈਡਫੋਨ ਦੇਖੇ ਸੀ ਤੇ ਪਸੰਦ ਆ ਗਏ ਮੈਨੂੰ ਤੇ ਉਹ ਆਰਡਰ ਕੀਤੇ ਲੈਣੇ ਹੈਡਫੋਨ ਹੀ ਤੇ ਹੁਣ ਇੱਕ ਮੈਂ ਵੈਸੇ ਵੇਖਣ ਲੱਗ ਪਿਆ ਸ਼ੂਜ ਤੇ ਸ਼ੂਜ ਮੈਨੂੰ ਉਥੇ ਵਧੀਆ ਲੱਗੇ ਮੈਂ ਕਿਹਾ ਚਲੋ ਠੀਕ ਆ ਮੈਂ ਲੈ ਲਏ ਸ਼ੂਜ ਲੈ ਲਏ ਤੇ ਵੇਖੇ ਤਾਂ ਬੜੇ ਸਟਾਈਲਿਸ਼ ਸੀ ਸਪੋਰਟਸ ਸ਼ੂਜ ਮੰਗਵਾਏ ਸੀ ਮੈਂ ਤੇ ਚਲੋ ਰਨਿੰਗ ਰੁਨਿੰਗ ਵਾਸਤੇ ਪਹਿਲਾਂ ਜਿਹੜਾ ਪ੍ਰੋਡਕਟ ਮੰਗਾਇਆ ਹੀ ਨਾ ਉਹ ਜਿੰਨੀ ਵਾਰੀ ਵੀ ਮੰਗਾਏ ਆ ਓਹ ਔਨ ਟਾਈਮ ਆਉਂਦੇ ਰਹੇ ਆ ਟਾਈਮ ਤੋਂ ਪਹਿਲਾਂ ਹੀ ਆ ਜਾਂਦੇ ਰਹੇ ਆਂ ਜੇ ਉਹਨਾਂ ਨੇ ਹਫਤੇ ਦਾ ਟਾਈਮ ਦੇਣਾ ਨਾ ਤਾਂ ਤਿੰਨ ਆ ਤਿੰਨ ਤੋਂ ਚਾਰ ਦਿਨ ਦੇ ਵਿੱਚ ਵਿੱਚ ਪ੍ਰੋਡਕਟ ਮੇਰੇ ਕੋਲ ਮਗਰ ਇਸ ਵਾਰੀ ਤੇ ਤੋਬਾ ਹੀ ਕਰਾ ਤੀ ਇਹਨਾਂ ਨੇ ਪੱਚੀ ਦਿਨ ਬਾਅਦ ਪ੍ਰੋਡਕਟ ਮੈਨੂੰ ਮਿਲਿਆ

ਤੇ ਮੈਂ ਕਿਹਾ ਠੀਕ ਹੈ ਜੀ ਇੱਕ ਜਿਹੜੀ ਚੀਜ਼ ਹੈਗੀ ਆ ਮੰਗ ਆਰਡਰ ਕੀਤੀ ਸੀ

ਹੈਡਫੋਨ ਜਿਹੜੇ ਹੀ ਹੈਡਫੋਨ ਖਰਾਬ ਆਏ ਹੈਡਫੋਨ ਦੋਨੋਂ ਸਾਈਡਾਂ ਨੀ ਚਲਦੀਆਂ ਤੇ ਚਲੋ ਸ਼ੂਜ ਸੀ ਜਿਹੜੇ ਜਿਹੜੇ ਮੈਂ ਆਰਡਰ ਕੀਤੇ ਉਹ ਸ਼ੂਜ ਈ ਹੈ ਨੀ ਸ਼ੂਜ ਵੀ ਵੱਖਰੇ ਆਏ ਆ ਉਹ ਰੰਗ ਜਿਹੜਾ ਆਰਡਰ ਕੀਤਾ ਸੀ ਉਹ ਰੰਗ ਹੀ ਹੈ ਨੀ ਮੈਂ ਵਾਈਟ ਕੀਤੇ ਸਲੈਕਟ ਇਹਨਾਂ ਨੇ ਉਹ ਬਲੈਕ ਭੇਜ ਤੇ ਬਲੈਕ ਮੈਨੂੰ ਨਹੀਂ ਚੰਗੇ ਲੱਗਦੇ ਮੈਂ ਕੀਤੇ ਨੀ ਆਰਡਰ ਨੀ ਕੀਤੇ ਤੇ ਤੇ ਜਿਹੜੇ ਉਹ ਨੀ ਆ ਰੱ ਰੱਦੀ ਜਾਂ ਜਿਹਨੂੰ ਕਹਿੰਦੇ ਨਾ ਆਪਾਂ ਉਦਾਂ ਦਾ ਸੀ ਸ਼ੂਜ ਦਾ ਤੇ ਤਾਂ ਕਰਕੇ ਫਿਰ ਮੈਂ ਕਿਹਾ ਨਹੀਂ ਯਾਰ ਹੈਨੀ ਐਸ ਵਾਰੀ ਥੋੜਾ ਜਿਹਾ ਕਰਤਾ ਹੈਡਫੋਨ ਵੀ ਖਰਾਬ ਭੇਜ ਦਿੱਤੇ ਜਦੋਂ ਪੈਸੇ ਪੂਰੇ ਦੇਣੇ ਆ ਮੈਂ ਤੇ ਚੀਜ਼ ਵੀ ਚੰਗੀ ਭੇਜਣੀ ਚਾਹੀਦੀ ਹੈ ਨਾ ਮਾੜੀ ਚੀਜ਼ ਭੇਜ ਦੋ ਫਿਰ ਉਹਦਾ ਕਿਆ ਫਾਇਦਾ ਐਸ ਕਰਕੇ ਐਸ ਵਾਰੀ ਦੋਨੋਂ ਚੀਜ਼ਾਂ ਇਹਨਾਂ ਨੇ ਖਰਾਬ ਭੇਜੀਆਂ ਮੈਨੂੰ ਧੰਨਵਾਦ ਜੀ